ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਹੋਰ ਕੀ ਕਰਦੇ ਅੱਛਾ ਅੱਛਾ ਮੈਂ ਸੁਣਿਆ ਤੇਰੇ ਬਰਦਰ ਦਾ ਵਿਆਹ ਸੀ ਹਾਂਜੀ ਅਤੇ ਫਿਰ ਕਰ ਲਈ ਸ਼ੋਪਿੰਗ ਸ਼ੁਪਿੰਗ ਹਾਜ ਹਾਂਜੀ ਹਾਂਜੀ ਇਹ ਤਾਂ ਹੈ ਹਾਂ ਟਰੈਫਿਕ ਤਾਂ ਬਹੁਤ ਹੀ ਹਾਂਜੀ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਆਹੋ ਇਹ ਤਿਉਹਾਰਾਂ ਦੇ ਦਿਨ ਆ ਉੱਪਰ ਵਿਆਹਾਂ ਦੇ ਸੀਜ਼ਨ ਚਲਦਾ ਪਿਆ ਅਤੇ ਮਾਰਕਿਟ 'ਚ ਰੱਸ਼ ਹੀ ਬਹੁਤ ਜ਼ਿਆਦਾ ਹਾਂ ਤਿਉਹਾਰ ਦੇ ਬਸ ਬਸ ਵਧੀਆ ਮੈਂ ਕਿਹਾ ਪੁੱਛਾ ਸ਼ੋਪਿੰਗ ਕਰਦੇ ਕਿ ਨਹੀਂ ਇੱਕ ਉਹ ਅੱਜ ਕੱਲ੍ਹ ਤਾਂ ਨਿੱਤ ਉਹ ਧਰਨੇ ਧੁਰਨੇ ਧਰਨੇ ਧਰਨੇ ਬਹੁਤ ਲੱਗਦੇ ਨਾ ਉਹਦੇ ਕਾਰਨ ਵੀ ਬਹੁਤ ਟਰੈਫਿਕ ਜਾਮ ਹੁੰਦਾ

ਹਾਂਜੀ ਹਾਂਜੀ ਇੱਕ ਅੱਜ ਕੱਲ੍ਹ ਲੋਕੀ ਜਾਣਾ ਨਾ ਤੁਹਾਡੇ ਮਾੜਾ ਮੋਟਾ ਸਮਾਨ ਲਿਆਉਣ ਜਾਣਾ ਹੋਵੇ ਤਾਂ ਵੀ ਵਹੀਕਲ ਤੇ ਲੈ ਕੇ ਜਾਂਦੇ ਪੈਦਲ ਜਾਂਦੇ ਨਹੀਂ ਹਾਂ ਹਾਂ ਚਲੋ ਠੀਕ ਹੈ ਫਿਰ ਓਕੇ ਬਾਏ